ਕਰਜ਼ਾ ਪਿੰਡਾਂ ਦੇ ਲੋਕਾਂ ਲਈ ਆਮ ਜੀ ਗੱਲ ਬਣ ਗਈ ਹੈ ਕਿਉਂਕਿ ਪਿੰਡਾਂ ਦੇ ਵਿੱਚ ਵੀ ਸਹਿਕਾਰੀ ਸਭਾਵਾਂ ਬਣੀਆਂ ਹਨ ਜੋ ਕਿ ਛਮਾਹੀ ਦੇ ਛਮਾਹੀ ਹਰ ਇੱਕ ਕਿਸਾਨ ਨੂੰ ਆਪਣੀ ਫਸਲ ਲਈ ਕਰਜ਼ਾ ਲੈ ਕੇ ਕਰਜ਼ਾ ਦਿੰਦੇ ਹਨ ਕਿਸਾਨ ਉਹਨਾਂ ਤੋਂ ਕਰਜ਼ਾ ਲੈ ਕੇ ਆਪਣੀ ਫਸਲ ਦਾ ਕੰਮ ਨਿਬੇੜਦਾ ਹੈ ਅਤੇ ਛਮਾਹੀ ਤੋਂ ਬਾਅਦ ਜਦੋਂ ਫਸਲ ਆਉਂਦੀ ਹੈ ਉਸਦਾ ਉਹ ਕਰਜ਼ਾ ਚੁਕਾਉਂਦਾ ਹੈ ਕਰਜ਼ਾ ਲੈਣ ਲਈ ਸਹਿਕਾਰੀ ਸਭਾਵਾਂ ਜਾਂ ਬੈਂਕਾਂ ਨਾਲ ਸੰਪਰਕ ਕਰਨਾ ਬਣਦਾ ਹੈ ਸੰਪਰਕ ਕਰਕੇ ਕਿਸਾਨ ਜੋ ਕਰਜ਼ਾ ਲੈਂਦੇ ਹਨ ਉਹਨਾਂ ਦੇ ਪ੍ਰਭਾਵ ਕੁਛ ਹੱਦ ਚੰਗੇ ਵੀ ਹਨ ਪਰ ਜ਼ਿਆਦਾਤਰ ਮਾੜਾ ਹੀ ਪ੍ਰਭਾਵ ਹਨ ਚੰਗਾ ਇਹ ਹੈ ਕਿ ਕਿਸਾਨ ਆਪਣੀਆਂ ਲੋੜਾਂ ਦੀ ਪੂਰਤੀ ਕਰ ਲੈਂਦਾ ਹੈ ਮਾੜੇ ਪ੍ਰਭਾਵ ਇਹ ਹਨ ਕਿ ਉਹ ਕਰਜ਼ਾ ਕਈ ਵਾਰ ਕਈ ਕਈ ਸਾਲ ਨਹੀਂ ਉਤਰਦਾ ਜਿਸ ਕਾਰਨ ਜਿਹੜਾ ਕਿਸਾਨ ਹੈ ਉਹ ਬੈਂਕ ਨੂੰ ਵਾਧੂ ਅਦਾਇਗੀ ਵਿਆਜ ਦੇ ਰੂਪ ਵਿੱਚ ਕਰਦਾ ਹੈ ਜਿਹਦਾ ਕਿ ਸਿੱਟਾ ਕਈ ਵਾਰ ਬਹੁਤ ਮਾੜਾ ਨਿਕਲਦਾ ਹੈ ਕਿਸਾਨਾਂ ਨੂੰ ਕਰਜ਼ਾ ਉਤਾਰਦੇ ਸਮੇਂ ਕਈ ਕਈ ਸਾਲ ਲੱਗ ਜਾਂਦੇ ਹਨ ਪਰੰਤੂ ਇਹ ਹੈ ਕਿ ਇਸਦੀ ਪੋਜ਼ੀਟਿਵ ਗੱਲ ਇਹੀ ਹੈ ਕਿ ਕਿਸਾਨ ਕਿਸਾਨ ਹੈ ਜਿਹੜੇ ਪਿੰਡ ਵਾਸੀ ਉਹ ਕਰਜ਼ਾ ਲੈ ਕੇ ਆਪਣੀਆਂ ਲੋੜਾਂ ਦੀ ਪੂਰਤੀ ਕਰ ਸਕਦੇ ਹਨ